ਮੇਰੇ ਅਨੁਸਾਰ ਭੰਗੜਾ ਵਿੱਚ ਹੋਰ ਕਸਰਤਾਂ ਵਿਕਲਪਾਂ ਨਾਲ ਇੰਨਾ ਦਿਲਚਸਪ ਇਸ ਲਈ ਹੈ ਕਿਉਕਿ ਇਸ ਵਿੱਚ ਬਹੁਤ ਸਾਰੀ ਐਨਰਜੀ ਹੁੰਦੀ ਹੈ ਤੇ ਅੱਜ ਦੇ ਯੁੱਗ ਦੇ ਨੌਜਵਾਨ ਭੰਗੜਾ ਕਰਨਾ ਬਹੁਤ ਹੀ ਪਸੰਦ ਕਰਦੇ ਹਨ ਜੋ ਕੀ ਇੱਕ ਡਾਂਸ ਦਾ ਰੂਪ ਵੀ ਹੈ ਜਿਸ ਵਿੱਚ ਉਹਨਾਂ ਨੂੰ ਆਪਣੇ ਮਨ ਨੂੰ ਪਸੰਦ ਗਾਣਿਆਂ ਦੇ ਨੱਚਣ ਦਾ ਮੌਕਾ ਵੀ ਮਿਲ ਜਾਂਦਾ ਹੈ ਤੇ ਉਹਨਾਂ ਦੀ ਨਾਲ ਨਾਲ ਕਸਰਤ ਵੀ ਹੋ ਜਾਂਦੀ ਜਿਵੇਂ ਅੱਜ ਦੇ ਬਹੁਤ ਹੀ ਕਰਦੇ ਹਨ ਕਿ ਉਹਨਾਂ ਨੂੰ ਯੋਗਾ ਕਸਰਤ ਦੇ ਵਿੱਚ ਦਿਲਚਸਪ ਨਹੀਂ ਹਨ ਕਿ ਉਹਨਾਂ ਨੂੰ ਪੁੱਛਣਾ ਪਵੇਗਾ ਕਿ ਕਰਨਾ ਪਵੇਗਾ ਭੰਗੜਾ ਇਕ ਅਜਿਹਾ ਤਰੀਕਾ ਹੈ ਜਿਸ ਵਿੱਚ ਉਹ ਆਪਣੀ ਸ਼੍ਰੇਣੀ ਰੱਖ ਸਕਦੇ ਹਨ ਤੇ ਨਾਲ ਨਾਲ ਆਪਣੇ ਸਿਹਤ ਦਾ ਧਿਆਨ ਰੱਖੋ ਕੰਮ ਕਰਦੇ ਆ ਇਕ ਨੌਜਵਾਨ ਦੀ ਤਸਲੀ ਇਕ ਫੌਜੀ ਵੀ ਬਣ ਜਾਂਦੀ ਹੈ ਤੇ ਉਹ ਆਪਣੇ ਪੈਰੋਲਿਕਸ ਦੇ ਵਿੱਚ ਅੱਗੇ ਵੀ ਆਪਣਾ ਕਰੀਅਰ ਜਾਂ ਤੇ ਜਾ ਸਕਦੇ ਹਾਂ ਜਿਸ ਨਾਲ ਉਹਨਾਂ ਦੀ ਸੀ ਠੀਕ ਰਹਿੰਦੀ ਹੈ ਉਹਨਾਂ ਦਾ ਮਨ ਵੀ ਲੱਗਿਆ ਰਹਿੰਦਾ ਜਿਸ ਵਿੱਚ ਬਹੁਤ ਹੀ ਐਨਰਜੀ ਹੁੰਦੀ ਹ ਅਲੱਗ ਅਲੱਗ ਕਰੋ ਭੰਗੜੇ ਦੇ ਵਿੱਚ ਕਿਸੇ ਵੀ ਸਮੇਂ ਕਰ ਸਕਦੇ ਹਨ ਜਿਵੇਂ ਇੱਕ ਆਫਟਰ ਬੁਕ ਕਸਰਤ ਕਰਨ ਸਮੇਂ ਖਾਲਸ ਕਰਦੇ ਹਨ ਰੁਜੀਆਂ ਰਹਿੰਦਾ ਹੈ ਤੇ ਇਸ ਨੂੰ ਕਰਕੇ ਖੁਸ਼ੀ ਵੀ ਮਿਲਦੀ ਹੈ ਕਿ ਉਹਨਾਂ ਦੀ ਸਿਹਤ ਉਹਨਾਂ ਦੇ ਸਿਰ ਚ ਵੀ ਠੀਕ ਰਹਿੰਦੀ